ਜਿਵੇਂ ਸਾਨੂੰ ਪਤਾ ਹੀ ਆ ਕਿ ਵੱਖ ਵੱਖ ਰਾਜਾਂ ਦੀ ਵੱਖ ਵੱਖ ਦੇਸ਼ਾਂ ਦੀ ਵੱਖਰੀ ਵੱਖਰੀ ਪਛਾਣ ਹੁੰਦੀ ਆ ਉਸ ਤਰ੍ਹਾਂ ਹੀ ਸਾਡੇ ਪੰਜਾਬ ਦੀ ਵੀ ਆਪਦੀ ਇੱਕ ਵੱਖਰੀ ਪਛਾਣ ਆ ਇਸ ਜਿਵੇਂ ਸਾਨੂੰ ਪਤਾ ਹੀ ਹੈ ਕਿ ਪਹਿਲੇ ਸਮਿਆਂ ਵਿੱਚ ਬਹੁਤ ਵਧੀਆ ਰਾਜੇ ਹੁੰਦੇ ਸੀਗੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਪੰਜਾਬ ਨੂੰ ਚਲਾਇਆ ਬਹੁਤ ਵਧੀਆ ਢੰਗ ਨਾਲ ਰਾਜ ਕੀਤਾ ਅਤੇ ਆਪਦੀ ਪ੍ਰਜਾ ਦਾ ਵੀ ਸਾਥ ਦਿੱਤਾ ਉਸ ਤਰ੍ਹਾਂ ਹੀ ਬਾਅਦ ਵਿੱਚ ਮੁਗਲਾਂ ਨੇ ਰਾਜ ਕਰ ਲਿਆ ਸਾਡੇ 'ਤੇ ਜਿਹਦਾ ਬਹੁਤ ਹੀ ਮਾੜਾ ਅਸਰ ਪਿਆ ਸਾਡੇ ਪੰਜਾਬ ਉੱਪਰ ਸਾਡੇ ਪੰਜਾਬ ਨੂੰ ਪਹਿਲਾਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਮੁਗਲ ਆਏ ਉਹਨਾਂ ਨੇ ਸਾਡੇ ਦੇਸ਼ 'ਤੇ ਕਬਜ਼ਾ ਕਰ ਲਿਆ ਸਾਡੇ ਦੇਸ਼ 'ਚੋਂ ਬਹੁਤ ਲੁੱਟਾਂ ਕੀਤੀਆਂ ਜਿਵੇਂ ਸੋਨਾ ਹੀਰੇ ਇੱਦਾਂ ਦਾ ਸਾਰਾ ਕੁਝ ਲੁੱਟ ਲਿਆ ਅਤੇ ਉਹਨਾਂ ਆਪਣੇ ਦੇਸ਼ 'ਚੋਂ ਮਤਲਬ ਵਪਾਰ ਹੁੰਦਾ ਸੀਗਾ ਬਹੁਤ ਵਧੀਆ ਵਪਾਰ ਹੁੰਦਾ ਸੀ ਅਤੇ ਉਹ ਸਾਰੀਆਂ ਮਤਲਬ ਵਪਾਰ ਵਾਲੀਆਂ ਚੀਜ਼ਾਂ ਆਪਦੇ ਦੇਸ਼ ਲਿਜਾਣ ਲੱਗ ਪਏ ਜਿਹਦੇ ਨਾਲ ਸਾਡਾ ਮਤਲਬ ਇਤਿਹਾਸ ਬਹੁਤ ਹੀ ਵਿਗੜ ਗਿਆ ਅਤੇ ਪੰਜਾਬ ਨੂੰ ਸਾਰਾ ਕੁਛ ਸੋਨੇ ਦੀ ਚਿੜੀ ਕਹਿੰਦੇ ਸੀਗੇ ਅਤੇ ਸੋਨੇ ਦੀ ਚਿੜੀ ਤੋਂ ਬਦਲ ਗਿਆ ਕਿਉਂਕਿ ਜਿਹੜੀ ਵੀ ਚੀਜ਼ ਸੀਗੀ ਜਿਸ ਕਰਕੇ ਸਾਨੂੰ ਆਮਦਨ ਆਉਂਦੀ ਸੀਗੀ ਜਿਹਦੇ ਕਰਕੇ ਸਾਨੂੰ ਪੈਸਾ ਆਉਂਦਾ ਸੀਗਾ ਜਦੋਂ ਉਹ ਚੀਜ਼ ਹੀ ਨਹੀਂ ਰਹੀ ਤਾਂ ਸਾਨੂੰ ਪੈਸਾ ਕਿੱਥੋਂ ਆਉਣਾ ਵਾ ਇੱਦਾਂ ਹੀ ਜਦੋਂ ਪੈਸਾ ਨਾ ਹੋਇਆ ਤਾਂ ਸਾਡਾ ਦੇਸ਼ ਗਰੀਬ ਹੋਣ ਲੱਗ ਪਿਆ ਲੋਕਾਂ ਵਿੱਚ ਕਮੀ ਆ ਗਈ ਪੈਸੇ ਦੀ ਅਤੇ ਸਾਰੇ ਲੋਕ ਨੌਕਰੀਆਂ ਤੋਂ ਹਟ ਗਏ ਕਿਉਂਕਿ ਸਾਰਾ ਰਾਜ ਮੁਗਲਾਂ ਦਾ ਹੋ ਗਿਆ ਸੀ ਅਤੇ ਪੰਜਾਬੀਆਂ ਨੂੰ ਨੌਕਰੀਆਂ ਘੱਟ ਦਿੰਦੇ ਸੀ ਮੁਗਲ ਲੋਕ ਇਸ ਕਰਕੇ ਪੰਜਾਬ ਵਿੱਚ ਗਰੀਬੀ ਆ ਗਈ ਜਿਹਦਾ ਬਹੁਤ ਹੀ ਮਾੜਾ ਪ੍ਰਭਾਵ ਪਿਆ ਵਾ ਸੋ ਧੰਨਵਾਦ